ਹਾਂਜੀ ਹੈਲੋ ਹਾਂਜੀ ਹਾਂਜੀ ਸੋਪ ਤੋਂ ਬੋਲ ਰਹੇ ਆ ਇਹ ਮਤਲਬ ਕਿਤਾਬਾਂ ਦੀ ਦੁਕਾਨ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੇ ਸਬਜੈਕਟ ਹੈਗੇ ਆ ਉਹਦੇ ਸਾਡੇ ਕੋਲੇ ਤੇ ਆਜਿਓ ਤੁਸੀਂ ਲੈ ਜਿਓ ਹਾਂਜੀ ਤੀਹ ਪ੍ਰਸੈਂਟ ਹਾਂਜੀ ਚਾਲੀ ਚਾਲੀ ਪ੍ਰਸੈਂਟ ਆ ਜੀ ਉਹ ਫਿਰ ਕੋਈ ਨਹੀਂ ਦੇਖ ਲਾਂਗੇ ਹਾਂਜੀ ਆਜਿਓ ਲੈ ਲਿਓ ਉਹ ਇੱਧਰ ਡੀ ਏ ਵੀ ਕੋਲਜ ਸੀਧਾ ਰੋਡ ਜਾ ਕੇ ਹਾਂ ਲੈਫਟ ਮੁੜ ਜਾਣਾ ਵਹੀ ਆਪਣੀ ਸ਼ੋਪ ਹਾਂਜੀ ਸ਼ੋਪ ਕਾ ਨਾਮ ਵੀਰ ਚੰਦ ਕੀ ਦੁਕਾਨ ਹੈ ਵੀਰ ਚੰਦ ਕੇ ਨਾਮ ਸੇ ਚਲਤੀ ਹੈ ਯੇ ਦੁਕਾਨ ਜੀ ਹਾਂ ਉੱਥੇ ਆ ਜਿਓ ਤੁਸੀਂ ਲੈ ਜਿਓ ਕੋਈ ਨੀ ਕਰਲਾਂਗੇ ਛੇ ਵਜੇ ਤੱਕ ਹੁੰਦੀ ਆ ਜੀ ਹਿੰਦੀ ਪੰਜਾਬੀ ਸਾਰੇ ਸਬਜੈਕਟ ਦੀਆਂ ਹੈਗੀਆਂ ਆਪਣੇ ਕੋਲੇ ਇੰਗਲਿਸ਼ ਹਾਂਜੀ ਸਭ ਸਾਰੀਆਂ ਹੈਗੀਆਂ ਆਪਣੇ ਕੋਲੇ ਆਜਿਓ ਕੋਈ ਨੀ ਤੁਸੀਂ ਤੇ ਹਾਂਜੀ ਸ਼ਾਮ ਛੇ ਵਜੇ ਤੱਕ ਰਹਿੰਦੀਆਂ ਉਹਦੇ ਬਾਇਦ ਸ਼ੋਪ ਬੰਦ ਹੁੰਦੀ ਐ ਤੇ ਹਾਂਜੀ ਦੇਖ ਲਿਓ ਤੁਸੀਂ ਆ ਜਿਓ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹੈਲੋ ਹਾਂਜੀ ਉਹ ਵੀ ਹੈਗੇ ਆ ਹਾਂਜੀ ਉਹ ਵੀ ਹੈਗੇ ਆ ਲੈ ਜੋ ਆਕੇ ਤੇ ਠੀਕ ਐ ਜੀ ਤੇ